ਮੈਂ ਪਰਸ ਖਰੀਦਿਆ ਸੀ ਬਜ਼ਾਰ ਵਿੱਚੋਂ ਲੋਕਲ ਅਤੇ ਉਹਦੇ ਮੈਨੂੰ ਬਹੁਤ ਫਾਇਦੇ ਮਿਲੇ ਨੇ ਉਹਦੇ ਵਿੱਚ ਤਿੰਨ ਚਾਰ ਜ਼ਿੱਪਾਂ ਨੇ ਅਤੇ ਉਹਦੇ ਵਿੱਚ ਮੇਰਾ ਪੂਰਾ ਸਮਾਨ ਆ ਜਾਂਦਾ ਖਾਣ ਪੀਣ ਦਾ ਵੀ ਆ ਜਾਂਦਾ ਹੈ ਮੈਨੂੰ ਉਹਦਾ ਬਹੁਤ ਫਾਇਦਾ ਹੋਇਆ ਬਹੁਤ ਅੱਛਾ ਨਿਕਲਿਆ ਸਾਲ ਹੋ ਗਿਆ ਚਲ ਰਿਹਾ ਹੈ